ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਗੁਰਪ੍ਰੀਤ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕਿ ਲੋਕਡਾਊਨ ਲੱਗਾ ਸੀਗਾ ਅਤੇ ਆਮਦਨ ਸਾਰਿਆਂ ਦੀ ਬੰਦ ਹੋ ਗਈ ਸੀ ਜਿਸ ਕਰਕੇ ਲੋਕਾਂ ਨੇ ਯੂਟਿਊਬਾਂ 'ਤੇ ਗੇਮਸ ਦੀ ਵੀਡੀਓ ਕੋਮੇਡੀਅਨ ਦੀ ਵੀਡੀਓਜ ਬਣਾ ਕੇ ਅਪਲੋਡ ਕਰਨੀਆਂ ਅਤੇ ਨੇਚਰ ਦੀਆਂ ਵੀਡੀਓ ਬਣਾ ਕੇ ਅਪਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਉਹਨਾਂ ਦੇ ਵਿਊਜ਼ ਆਉਣ ਦੇ ਨਾਲ ਉਹਨਾਂ ਨੂੰ ਪੈਸੇ ਮਿਲਦੇ ਸਨ ਅਤੇ ਇਸ ਕੁਝ ਸਾਲਾਂ ਦੇ ਵਿੱਚ ਵਿੱਚ ਇਹ ਯੂਟਿਊਬਰਾਂ ਦਾ ਯੁੱਗ ਸ਼ੁਰੂ ਹੋ ਗਿਆ ਇਹਨਾਂ ਵਿੱਚ ਕਈ ਲੋਕ ਯੂਟਿਊਬ ਵਿੱਚ ਅਤੇ ਆਪਣੇ ਚੈਨਲ ਬਣਾ ਕੇ ਗਾਣੇ ਗਾ ਕੇ ਪੈਸੇ ਕਮਾਉਂਦੇ ਹਨ ਕਈ ਪਬਜੀ ਗੇਮਾਂ ਖੇਡ ਕੇ ਉਹਨਾਂ ਦੇ ਸ਼ੋਟਸ ਪਾ ਕੇ ਪੈਸੇ ਕਮਾਉਂਦੇ ਹਨ ਜੋ ਕਿ ਬਹੁਤ ਹੀ ਵਧੀਆ ਗੱਲ ਹੈਗੀ ਆ ਘਰ ਬੈਠੇ ਪੈਸੇ ਕਮਾਉਣੇ